ਹੈਲੋ ਹਾਂਜੀ ਮੈਂ ਅਮਨਪ੍ਰੀਤ ਬੋਲਦੀ ਹਾਂ ਤੁਸੀਂ ਬੰਬੇ ਫਰਨੀਚਰ ਤੋਂ ਬੋਲਦੇ ਓਂ ਹਾਂਜੀ ਮੈਨੇ ਨਾ ਡਬਲ ਬੈਡ ਖਰੀਦਣੀ ਸੀਗੇ ਜੀ ਉਹਦੀ ਕੀ ਰੇਂਜ ਕੀ ਵਰਾਇਟੀ ਹੋਏਗੀ ਤੁਹਾਡੇ ਕੋਲ ਓਕੇ ਜੀ ਠੀਕ ਹੈ ਜੀ ਠੀਕ ਹੈ ਅਤੇ ਇੱਕ ਮੈਂ ਡਾਇਨਿੰਗ ਟੇਬਲ ਖਰੀਦਣਾ ਚਾਹੁੰਦੀ ਹਾਂ ਅਤੇ ਉਹਦੇ ਬਾਰੇ ਥੋੜ੍ਹਾ ਦੱਸੋ ਜੀ ਉਹਦੀ ਰੇਂਜ ਕੀ ਹੋਏਗੀ ਕਿਉਂਕਿ ਫਿਰ ਮੈਂ ਆਪਦੇ ਓਕੇ ਜੀ ਇੱਕ ਸੋਫਾ ਸੈਟ ਦੀ ਰੇਂਜ ਦੱਸੋ ਜੀ ਮੈਨੂੰ ਸੋਫਾ ਸੈਟ ਵੀ ਇੱਕ ਮੈਂ ਖਰੀਦਣਾ ਚਾਹੁੰਦੀ ਹਾਂ ਓਕੇ

ਠੀਕ ਹੈ ਜੀ ਅਤੇ ਕਪਬੋਰਡ ਦੀ ਕੀ ਕੀ ਰੇਂਜ ਆ ਤੁਹਾਡੇ ਕੋਲ ਓਕੇ ਜੀ ਅਤੇ ਤੁਹਾਡੀ ਤੁਹਾਡੀ ਸ਼ੋ ਅਤੇ ਤੁਹਾਡੀ ਸ਼ੋਪ ਦੀ ਕੀ ਟਾਈਮਿੰਗ ਆ ਜੀ ਕਦੋਂ ਤੱਕ ਓਪਨ ਹੁੰਦੀ ਆ ਓਕੇ ਜੀ ਫਿਰ ਮੈਂ ਕਿਸੇ ਵੀ ਦਿਨ ਹਾਂਜੀ ਮੈਂ ਕਿਸੇ ਵੀ ਦਿਨ ਆ ਕੇ ਵਿਜਿਟ ਕਰਕੇ ਦੇਖਾਂਗੀ ਜੀ ਫਿਰ ਦੇਖ ਕੇ ਹੀ ਮੈਂ ਬਾਏ ਕਰਾਂਗੀ ਜੋ ਵੀ ਮੇਰਾ ਬਜਟ ਹੋਏਗਾ ਠੀਕ ਠੀਕ ਹੈ ਜੀ ਮੈਂ ਪਟਿਆਲਾ ਤੋਂ ਬੋਲਦੀ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਓਕੇ ਓਕੇ